ਕਈ ਵਾਰ ਡਰ ਤਰਕ ਨਾਲੋਂ ਕਿਵੇਂ ਬਲਵਾਨ ਹੋ ਜਾਂਦਾ ਹੈ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸਹਿਜ ਸੁਭਾਅ ਦਾ ਤਰਕ ਵਿੱਚੋਂ ਲੱਗਦਾ ਹੈ ਧੰਨਵਾਦ